ਸਤਿ ਸ਼੍ਰੀ ਅਕਾਲ ਜੀ ਹਾਂਜੀ ਬੋਲ ਰਿਹਾ ਸਰ ਅੱਛਾ ਅੱਛਾ ਬਿਲਕੁਲ ਸਰ ਦੱਸੋ ਜੀ ਕੀ ਜਾਣਕਾਰੀ ਚਾਹੀਦੀ ਆ ਥਿਏਟਰ ਭਾਅ ਜੀ ਇੱਥੇ ਦੋ ਥਿਏਟਰ ਨੇ ਇੱਕ ਤਾਂ ਹੈਗਾ ਇਹਦਾ ਹਾਂ ਸਮਰਾਟ ਸਿਨੇਮਾ ਹੈ ਇੱਕ ਹੈ ਗ੍ਰੈਂਡ ਮੋਲ ਦੇ ਵਿੱਚ ਹੈ ਜਿਹੜਾ ਸਮਰਾਟ ਸਿਨੇਮਾ ਤਾਂ ਹੈ ਸਰ ਇਹ ਜਦੋਂ ਖੋਖਰ ਰੋਡ ਆਪਾਂ ਜਾਂਦੇ ਹਾਂ ਉੱਧਰਲੇ ਪਾਸੇ ਆ ਜਾਵੇਗਾ ਬਟ ਜਿਹੜਾ ਗ੍ਰੈਂਡ ਸਿਨੇਮਾ ਹੈ ਇਹ ਜਦੋਂ ਆਪਾਂ ਕੈਂਚੀਆਂ ਰੋਡ ਨੂੰ ਜਾਂਦੇ ਹਾਂ ਤਾਂ ਉੱਥੇ ਆ ਉੱਥੇ ਖਾਣ ਪੀਣ ਨੂੰ ਵੀ ਤੁਹਾਨੂੰ ਵਧੀਆ ਮਿਲ ਜਾਵੇਗਾ ਸਮਾਨ ਠੀਕ ਹੈ ਅਤੇ ਨਾਲ ਕਾਫੀ ਆਊਟਲੈਟਸ ਵਗੈਰਾ ਵੀ ਆ ਉੱਥੇ ਜੇ ਤੁਸੀਂ ਸ਼ੋਪਿੰਗ ਕਰਨੀ ਹੈ ਪੀਣਾ ਹੈ ਨਾ ਤਾਂ ਉੱਥੇ ਬੱਚਿਆਂ ਲਈ ਠੀਕ ਹੈ ਫੈਮਲੀ ਲਈ ਠੀਕ ਹੈ ਹਾਂਜੀ ਕੀ ਸਰ

ਇੱਕ ਖੋਖਰ ਰੋਡ 'ਤੇ ਜੀ ਹਾਂਜੀ ਇੱਕ ਖੋਖਰ ਰੋਡ 'ਤੇ ਹੈ ਬਟ ਉੱਥੇ ਨਾ ਜਾਈਓ ਤੁਸੀਂ ਮੈਂ ਤੁਹਾਨੂੰ ਇਹੀ ਕਹਾਂਗਾ ਤੁਸੀਂ ਗ੍ਰੈਂਡ ਮਾਲ ਦੇ ਵਿੱਚ ਜਾਓ ਉੱਥੇ ਖਾਣ ਪੀਣ ਨੂੰ ਆਪਸ਼ਨ ਜ਼ਿਆਦਾ ਨੇ ਸਿਨੇਮਾ ਹਾਲ ਜ਼ਿਆਦਾ ਵਧੀਆ ਹੈ ਨਾ ਕੁਆਲਿਟੀ ਜ਼ਿਆਦਾ ਵਧੀਆ ਥੋੜ੍ਹਾ ਫੈਮਲੀ ਲਈ ਠੀਕ ਆ ਉਹ ਚੀਜ਼ ਹੈ ਨਾ ਨੀਚੇ ਰੈਸਟੋਰੈਂਟ ਹੈ ਤੁਸੀਂ ਮੂਵੀ ਦੇਖੋ ਥੋੜ੍ਹਾ ਨੀਚੇ ਖਾਣ ਪੀਣ ਨੂੰ ਵਧੀਆ ਸ਼ੋਪਿੰਗ ਆਊਟਲੈਟਸ ਵੀ ਖੁੱਲ੍ਹੇ ਹੋਏ ਨੇ ਕਾਫੀ ਹਾਂ ਫੈਮਲੀ ਉਹ ਮੋਲ ਦੇ ਵਿੱਚ ਜਾਣ ਦਾ ਫਾਇਦਾ ਜੀ ਹਾਂਜੀ ਹਾਂਜੀ ਹਾਂਜੀ ਘੁੰਮਣ ਲਈ ਥਾਂ ਜੀ ਇੱਕ ਇੱਕ ਦੋ ਪਾਰਕ ਹੈਗੇ ਨੇ ਕਾਫੀ ਅੱਛੇ ਪਾਰਕ ਨੇ ਨਵੇਂ ਬਣਾਏ ਨੇ ਗੋਰਮੈਂਟ ਨੇ ਹੈ ਨਾ ਸੈਂਟਰਲ ਪਾਰਕ ਹੈ ਇੱਥੇ ਸ਼ਾਮ ਨੂੰ ਕਾਫੀ ਰੌਣਕ ਹੁੰਦੀ ਹੈ ਮਤਲਬ ਬੱਚਿਆਂ ਦੇ ਖੇਡਣ ਨੂੰ ਕਾਫੀ ਸਾਰੇ ਗਰਾਊਂਡ ਵੀ ਬਣੇ ਹੋਏ ਨੇ ਬੈਡਮਿੰਟਨ ਦਾ ਗਰਾਊਡ ਬਾਸਕਿਟਬੋਲ ਦਾ ਗਰਾਉਂਡ ਹੈ ਨਾ ਸਵੀਮਇੰਗ ਪੂਲ ਕਾਫੀ ਚੀਜ਼ਾਂ ਹੈਗੀਆਂ ਨੇ ਸ਼ਾਮ ਨੂੰ ਆਓ ਕਾਫੀ ਰੌਣਕ ਹੁੰਦੀ ਹੈ ਕਾਫੀ ਮਤਲਬ ਸੈਰ ਸੂਰ ਕਰਨ ਆਉਂਦੇ ਨੇ ਲੋਕ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਕੋਈ ਦਿੱਕਤ ਨਹੀਂ ਜੀ ਜਦੋਂ ਲੋੜ ਹੋਈ ਦੁਬਾਰਾ ਫੋਨ ਲਾਈਓ ਠੀਕ ਹੈ ਜੀ ਓਕੇ ਜੀ